ਹਾਂਜੀ ਅੱਛਾ ਜੀ ਤੁਹਾਡੀ ਕੁਆਲੀਫਿਕੇਸ਼ਨ ਕਿਆ ਏ ਅਤੇ ਪਲੱਸ ਟੂ 'ਚ ਕਿੰਨੇ ਮਤਲਬ ਕਿ ਪ੍ਰਸੈਂਟੇਜ ਹੈ ਓਕੇ ਪ੍ਰਸੈਂਟੇਜ ਤਾਂ ਅੱਛੀ ਹੈ ਹੁਣ ਇਹਦੇ ਵਿੱਚ ਅਗਰ ਤੁਸੀਂ ਸਿਕਸ ਪੁਆਇੰਟ ਫਾਈਵ ਲਾਈਜ਼ ਤੋਂ ਉੱਪਰ ਬੈਂਡਜ਼ ਲੈ ਲੈਂਦੇ ਹੋ ਤਾਂ ਤੁਹਾਨੂੰ ਸਕਾਲਰਸ਼ਿਪ ਵੀ ਮਿਲੇਗੀ ਵੈਸੇ ਸਿਕਸ ਪੁਆਇੰਟ ਫਾਈਵ ਰਿਕੁਆਈਰ ਹੈ ਓਵਰਆਲ ਔਰ ਸਿਕਸ ਈਚ ਲੈਣੇ ਪੈਣੇ ਆ ਤੁਹਾਨੂੰ ਹਰੇਕ ਮੋਡੀਉਲ 'ਚ ਹਾਂਜੀ ਹਾਂਜੀ ਇ ਇਹ ਜਿਵੇਂ ਕਿ ਇਹਦੇ ਚਾਰ ਮੋਡੀਊਲਜ਼ ਹੈ ਰੀਡਿੰਗ ਦੇ ਵਿੱਚ ਤਿੰਨ ਪੈ ਪੈਸੇਜ ਆਉਂਦੇ ਆ ਉਹਦੇ ਵਿੱਚ ਤੁਹਾਨੂੰ ਕੁਆਸ਼ਨ ਢੂੰਡਣੇ ਹੁੰਦੇ ਹੈ ਠੀਕ ਹੈ ਅਤੇ ਲਿਸਨਿੰਗ 'ਚ ਉਹ ਔਡੀਓ ਚਲਾ ਦਿੰਦੇ ਆ ਫਿਰ ਤੁਸੀਂ ਉਹਦੇ ਤੋਂ ਸੁਣ ਕੇ ਇੱਕ ਕੁਆਸ਼ਨਜ਼ ਦੇ ਆਨਸਰ ਦੇਣੇ ਹੈ ਅਤੇ ਸਪੀਕਿੰਗ ਵਿੱਚ ਸਪੀਕਿੰਗ ਦੇ ਤਿੰਨ ਟਾਸਕ ਹੁੰਦੇ ਆ ਫਸਟ ਵਿੱਚ ਉਹ ਤੁਹਾਨੂੰ ਜਨਰਲ ਕੁਆਸ਼ਨਜ਼ ਪੁੱਛਣਗੇ ਤੁਹਾਡੇ ਬਾਰੇ ਇੰਟਰੋਡਕਟਰੀ ਅਤੇ ਸੈਕਿੰਡ ਦੇ ਵਿੱਚ ਉਹ ਇੱਕ ਟੋਪਿਕ ਦੇਣਗੇ ਉਹਦੇ ਉੱਤੇ ਤੁਹਾਨੂੰ ਦੋ ਮਿੰਨਟ ਲਈ ਬੋਲ਼ਣਾ ਪਏਗਾ ਅਤੇ ਜਿਹੜਾ ਥਰਡ ਹੋਏਗਾ ਉਹਦੇ 'ਚ ਫੋਲੋ ਅੱਪ ਕੁਆਸ਼ਨਜ਼ ਪੁੱਛਣਗੇ ਵੈਸੇ ਨੋਰਮਲੀ ਤਿੰਨ ਚਾਰ ਮਹੀਨੇ ਲੱਗਦੇ ਹੈ ਬਟ ਅਗਰ ਤੁਸੀਂ ਆਪਣੇ ਬਿਹਾਫ 'ਤੇ ਚੰ ਚੰਗੀ ਪਰਫੋਮੈਂਨਸ ਦਿੰਦੇ ਹੋ ਤਾਂ ਦੋ ਮਹੀਨੇ 'ਚ ਵੀ ਹੋਜੇਗਾ ਹਾਂਜੀ ਨਹੀਂ ਜੁਆਇਨਿੰਗ ਲਈ ਕੋਈ ਪਰੂਫ ਵਗੈਰਾ ਨਹੀਂ ਚਾਹੀਦੇ ਹੈ ਤੁਸੀਂ ਇੱਕ ਵਾਰ ਆ ਕੇ ਵਿਜ਼ਿਟ ਕਰ ਲਉ ਅਗਰ ਡੈਮੋ ਲੈ ਕੇ ਦੇਖ ਲਉ ਇੱਕ ਦਿਨ ਅਗਰ ਤੁਹਾਨੂੰ ਚੰਗਾ ਚੰਗਾ ਲੱਗਦਾ ਹੈ ਤਾਂ ਜੁਆਇੰਨ ਕਰ ਲਉ

ਹਾਂਜੀ ਠੀਕ ਹੈ ਓਕੇ ਓਕੇ